ਮਨੁੱਖ ਨੂੰ ਹਮੇਸ਼ਾ ਆਪਣੀਆਂ ਜੁੜ ਜੜ੍ਹਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ ਸਾਡੀ ਸਾਡੀ ਜਿਹੜਾ ਜੜ੍ਹਾਂ ਹੀ ਸਾਨੂੰ ਵੱਡਾ ਰੁੱਖ ਬਣਾਉਂਦੀਆਂ ਹਨ ਜੋ ਕਿਸੇ ਦੀ ਕਿਸੇ ਲਈ ਸਹਾਇਕ ਵੀ ਹੁੰਦੀਆਂ ਹਨ ਛੋਟੇ ਹੁੰਦੇ ਜਦੋਂ ਨਿਆਣੇ ਨੂੰ ਸਕੂਲ ਦੇ ਵਿੱਚ ਭੇਜਦੇ ਹਨ ਤਾਂ ਉਹਨਾਂ ਦੇ ਟੀਚਰ ਉਹਨਾਂ ਨੂੰ ਛੋਟੀ ਛੋਟੀ ਗਲਤੀ 'ਤੇ ਡਾਂਟਦੇ ਹਨ ਤਾਂ ਕੀ ਉਹੀ ਗਲਤੀ ਜਿਹੜੀ ਆ ਦੁਬਾਰਾ ਨਹੀਂ ਕਰਦਾ ਸਾਨੂੰ ਛੋਟੇ ਹੁੰਦੇ ਟੀਚਰਾਂ ਨੇ ਸਾਨੂੰ ਦੱਸਣਾ ਵੀ ਹਿੰਦੀ ਦਾ ਸ਼ਬਦ ਇੱਦਾਂ ਨਹੀਂ ਇੱਦਾਂ ਬਣਦਾ ਪੰਜਾਬੀ ਸ਼ਬਦ ਇੱਦਾਂ ਨਹੀਂ ਇੱਦਾਂ ਬਣਦਾ ਉਹ ਪੰਜਾਬੀ ਜਿਹੜੀ ਹੈਗੀ ਪ੍ਰਫੁੱਲਤ ਹੋ ਕੇ ਜਦੋਂ ਮੈਂ ਰਿਪੋਰਟਰ ਬਣਿਆ ਪੱਤਰਕਾਰ ਬਣਿਆ ਉਹਦੇ ਵਿੱਚ ਬੜੀ ਸਹਾਇਕ ਹੋਈ ਅੱਜ ਵੀ ਜੇ ਕੋਈ ਗਲਤੀ ਹੁੰਦੀ ਹੈ ਕੋਈ ਲ ਅਲਫਾਜ਼ ਨਹੀਂ ਮਿਲਦੇ ਅਸੀਂ ਉਸ ਟੀਚਰ ਨੂੰ ਮਿਲ ਲਈ ਦਾ ਫੋਨ ਕਰ ਲਈ ਦਾ ਗੂਗਲ ਤੁਹਾਨੂੰ ਸਭ ਕੁਛ ਨਹੀਂ ਦੱਸ ਸਕਦਾ ਨੈੱਟ 'ਤੇ ਸਭ ਕੁਛ ਉਹਨੇ ਸਾਨੂੰ ਜਿਹੜੇ ਟੀਚਰ ਆ ਉਹ ਹੀ ਅੱਜ ਵੀ ਦੱਸ ਉਹ ਸਿਆਣੇ ਹੋ ਗਏ ਫਿਰ ਵੀ ਉਹ ਖੁਸ਼ ਹੁੰਦੇ ਜਦੋਂ ਚੇਲੇ ਉਹਨੂੰ ਮਿਲਦੇ ਹਨ ਅਤੇ ਉਹਦੇ ਵਿੱਚ ਸਾਡਾ ਵੀ ਭਲਾ ਆ ਵੀ ਅਸੀਂ ਉਹਦੇ ਕੋਲ ਜਾਂਦੇ ਹਾਂ ਉਹ ਸਾਨੂੰ ਹੋਰ ਖੁਸ਼ ਹੁੰਦਾ ਅਤੇ ਸਾਨੂੰ ਵੀ ਥੋੜ੍ਹਾ ਜਿਹਾ ਹੁੰਦਾ ਲੱਗਦਾ ਵੀ ਅਸੀਂ ਜਿਹੜੀ ਆ ਜੇ ਸਾਨੂੰ ਸਿਖਾਇਆ ਸੀ ਉਸ ਤੋਂ ਅੱਗੇ ਵਧੇ ਹਾਂ ਉਹਨਾਂ ਨੇ ਸਾਨੂੰ ਪੱਤਰਕਾਰ ਬਣ ਕੇ ਜ਼ਾਂ ਰਿਪੋਰਟਰ ਬਣ ਕੇ ਜ਼ਾਂ ਕਿਸੇ ਸਕੂਲ ਦੇ ਟੀਚਰ ਬਣ ਕੇ ਦੇਖਦੇ ਹਨ ਤਾਂ ਉਹਨਾਂ ਦੇ ਵੀ ਜਿਹੜੀ ਛਾਤੀ ਨਾਲ ਜਿਹੜਾ ਸ ਸੀਨਾ ਚੌੜਾ ਹੋ ਜਾਂਦਾ ਅਤੇ ਹੋਣਾ ਵੀ ਚਾਹੀਦਾ ਕਿਉਂਕਿ ਉਹਨਾਂ ਦੇ ਜਿਹੜੇ ਪੜ੍ਹਾਏ ਆ ਬੱਚੇ ਜਦੋਂ ਉਹਨਾਂ ਨੇ ਪੜ੍ਹਾਇਆ ਸਾਨੂੰ ਮਾੜੇ ਮਾੜੇ ਸ਼ਬਦ 'ਤੇ ਮਾਰਿਆ ਕੁੱਟਿਆ ਉਹ ਸਾਨੂੰ ਜਿਹੜਾ ਅੱਗੇ ਜਿਹੜੀ ਵੱਡੀ ਵੱਡਾ ਯਾਨੀ ਕਿ ਬੂਟਾ ਬਣ ਜਾਂਦਾ ਅਤੇ ਉਹ ਸਾਨੂੰ ਛਾਂ ਵੀ ਦਿੰਦਾ ਉਹਨਾਂ ਨੂੰ ਵੀ ਛਾਂ ਦਿੰਦਾ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਲੋੜ ਪੈਂਦੀ ਰਿਟਾਇਰਮੈਂਟ ਤੋਂ ਬਾਅਦ ਧਰਨੇ ਦੇ ਪ੍ਰਦਰਸ਼ਨ ਵੇਲੇ ਵੀ ਆਹ ਮੇਰੀ ਖ਼ਬਰ ਲਾਓ ਜਾਂ ਮੇਰੇ ਪੈਸੇ ਨਹੀਂ ਆਏ ਜਾਂ ਕੁਛ ਪੈਂਨਸ਼ਨ ਨਹੀਂ ਆਈ ਤਾਂ ਉਹਦੇ ਵਿੱਚ ਸਹਾਇਕ ਵੀ ਬੱਚਾ ਹੀ ਹੁੰਦਾ ਇਹ ਚਾਰੋਂ ਪਾਸੇ ਚੱਕਰ ਘੁੰਮਦਾ ਰਹਿੰਦਾ ਕੱਲ੍ਹ ਤੁਹਾਨੂੰ ਲੋੜ ਸੀਗੀ ਅੱਜ ਤੁਹਾਨੂੰ ਉਨਾਂ ਨੂੰ ਲੋੜ ਪੈਂਦੀ ਤਾਂ ਤੁਹਾਨੂੰ ਨਾਲ ਖੜਨਾ ਚਾਹੀਦਾ ਜ਼ਰੂਰੀ ਆ ਹਮੇਸ਼ਾ ਸਾਨੂੰ ਆਪਣੀ ਜੜ੍ਹਾਂ ਨਾਲ ਜੁੜਿਆ ਰਹਿਣਾ ਚਾਹੀਦਾ ਜਿਹੜੀ ਕੌਮ ਜੜ੍ਹਾਂ ਨਾਲ ਨਹੀਂ ਜੁੜਦੀ ਉਹ ਖਤਮ ਹੋ ਜਾਂਦੀ ਆ ਸਮਾਪਤ ਹੋ ਜਾਂਦੀ ਆ